ਅਸੀਂ ਆਪਣੇ ਲਿਖੇ ਵਿੱਚ ਸੰਪਾਦਨ ਅਤੇ ਸੰਸ਼ੋਧਨ ਕਿਵੇਂ ਸੰਭਾਲਦੇ ਹਾਂ ਪਹਿਲਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਨਲਾਈਨ ਐਪਸ ਨੇ ਜਾਂ ਸਾਈਜ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਕਿ ਉਹ ਜਦੋਂ ਉਹਦੇ ਉੱਤੇ ਆਪਾਂ ਆਪਣਾ ਲੇਖ ਜਾਂ ਆਪਣੀ ਲਿਖਤੀ ਚੜਾਉਂਦੇ ਹਾਂ ਤਾਂ ਆਟੋਮੈਟਿਕਲੀ ਉਹ ਉਸਦੀ ਸੰਪਾਦਨ ਅਤੇ ਸੰਸ਼ੋਧਨ ਕਰ ਦਿੰਦੀ ਹੈ ਪਰ ਅਸੀਂ ਕਈ ਕੁ ਵਾਰ ਅਸੀਂ ਆਪਣੇ ਕਿਸੇ ਵੱਡੇ ਨੂੰ ਜਾਂ ਜਿਸ ਨੂੰ ਉਸ ਬਾਰੇ ਜ਼ਿਆਦਾ ਨਾਲੇਜ ਹੋਵੇ ਉਸਨੂੰ ਪੜ੍ਹਨ ਨੂੰ ਦਿੰਦੇ ਹਾਂ ਤਾਂ ਉਹ ਸਾਨੂੰ ਉਸ ਬਾਰੇ ਜਾਂ ਉਸ ਨੂੰ ਸਹੀ ਕਰਕੇ ਦਿੰਦਾ ਹੈ ਜੇਕਰ ਉਸ ਵਿੱਚ ਕੋਈ ਗਲਤੀ ਹੋਵੇ ਕਿਉਂਕਿ ਕਈ ਕੁ ਵਾਰ ਅਸੀਂ ਇਹੋ ਜਿਹੇ ਸ਼ਬਦ ਆਪਣੇ ਲੇਖ ਜਾਂ ਲਿਖਤੀ ਵਿੱਚ ਲਿਖ ਦਿੰਦੇ ਹਾਂ ਜੋ ਕਿ ਸਾਡੀ